ਪੰਜਾਬ ਵਿੱਚ ਵਿਆਹ ਬਹੁਤ ਧੂਮ ਧਾਮ ਨਾਲ ਕੀਤੇ ਜਾਂਦੇ ਹਨ ਵਿਆਹ ਵਿਆਹਾਂ ਉੱਤੇ ਬਹੁਤ ਖਰਚ ਕੀਤਾ ਜਾਂਦਾ ਹੈ ਪੈਲੇਸਾਂ ਵਿੱਚ ਵਿਆਹ ਹੁੰਦੇ ਹਨ ਬਹੁਤ ਖਰਚ ਹੁੰਦਾ ਹੈ ਜ਼ਿਆਦਾਤਰ ਲੋਕ ਵਿਆਹ ਦੇ ਉੱਤੇ ਲੜਕੀ ਨੂੰ ਸ਼ਗਨ ਦਿੰਦੇ ਹਨ ਕੁਝ ਰਿਸ਼ਤੇਦਾਰ ਗਹਿਣੇ ਵੀ ਦਿੰਦੇ ਹਨ ਜਿਵੇਂ ਕਿ ਮੁੰਦਰੀਆਂ ਸੋਨੇ ਦੇ ਸੈੱਟ ਆਦਿ ਕੱਪੜੇ ਵੀ ਦਿੰਦੇ ਹਨ ਇਹ ਇਹ ਹੀ ਜ਼ਿਆਦਾਤਰ ਤੋਹਫੇ ਹੁੰਦੇ ਹਨ ਆਪਣੀ ਆਪਣੀ ਵਰਤੋਂ ਹੁੰਦੀ ਹੈ ਕੁਝ ਰਿਸ਼ਤੇਦਾਰ ਲੜਕੀ ਨੂੰ ਫਰਿੱਜ ਟੀ ਵੀ ਵੀ ਤੋਹਫੇ ਵਿੱਚ ਦੇ ਦਿੰਦੇ ਹਨ ਕੀ ਦਾਜ ਦੇਣਾ ਚਾਹੀਦਾ ਹੈ ਲੜਕੀ ਨੂੰ ਇਹ ਪੁੱਛਿਆ ਗਿਆ ਕੇ ਕੀ ਦਾਜ ਦਿੱਤਾ ਜਾਂਦਾ ਹੈ ਦੇਣਾ ਚਾਹੀਦਾ ਹੈ ਲੜਕੀ ਨੂੰ ਦਾਜ ਇਹ ਦਾਜ ਦਾ ਨਾਂ ਹਟਾ ਦੇਣਾ ਚਾਹੀਦਾ ਹੈ ਇਹ ਤਾਂ ਲੜਕੀ ਵਾਸਤੇ ਇੱਕ ਸਨਮਾਨ ਹੈ ਲੜਕੀ ਨੂੰ ਜੋ ਕੁਝ ਅਸੀਂ ਦਿੰਦੇ ਹਾਂ ਆਪਣੀ ਸਮਰੱਥਾ ਅਨੁਸਾਰ ਉਹ ਲੜਕੀ ਦੇ ਜ਼ਰੂਰਤ ਦੀਆਂ ਚੀਜ਼ਾਂ ਹੁੰਦੀਆਂ ਹਨ ਤਾਂ ਕਿ ਲੜਕੀ ਆਪਣੇ ਸਹੁਰੇ ਪਰਿਵਾਰ ਵਿੱਚ ਸਨਮਾਨ ਨਾਲ ਰਹਿ ਸਕੇ ਜਿਨ੍ਹਾਂ ਚੀਜ਼ਾਂ ਦੀ ਉਸ ਨੂੰ ਜ਼ਰੂਰਤ ਹੈ ਉਹ ਚੀਜ਼ਾਂ ਜ਼ਰੂਰ ਦੇਣੀਆਂ ਚਾਹੀਦੀਆਂ ਹਨ ਦਾਜ ਨਾ ਕਹਿ ਕੇ ਇਸਨੂੰ ਸਨਮਾਨ ਕਹਿਣਾ ਪਸੰਦ ਕਰਾਂਗੀ ਲੜਕੀ ਜਦੋਂ ਆਪਣੇ ਸਹੁਰਿਆਂ ਘਰ ਜਾਂਦੀ ਹੈ ਉਸਨੂੰ ਕਿਸੇ ਚੀਜ਼ ਦੀ ਜ਼ਰੂਰਤ ਪੈਂਦੀ ਹੈ ਤਾਂ ਉਸ ਨੂੰ ਮੰਗਣ ਦੀ ਲੋੜ ਨਹੀਂ ਪੈਣੀ ਚਾਹੀਦੀ ਉਹਦੇ ਕੋਲ ਆਪਣੇ ਵਰਤੋਂ ਦੀਆਂ ਚੀਜ਼ਾਂ ਆਪ ਹੀ ਹੋਣੀਆਂ ਚਾਹੀਦੀਆਂ ਹਨ ਤਾਂ ਕਿ ਆਪਣੇ ਆਪ ਉਹ ਚੀਜ਼ ਹੱਕ ਨਾਲ ਉਹਨਾਂ ਚੀਜ਼ਾਂ ਨੂੰ ਵਰਤ ਸਕੇ ਇਸ ਕਰਕੇ ਮੈਂ ਕਹਾਂਗੀ ਇਹ ਦਾਜ ਜਿਹੜਾ ਇਹ ਜ਼ਰੂਰੀ ਆ ਲੜਕੀਆਂ ਨੂੰ ਦੇਣਾ ਅਤੇ ਜੇ ਕੋਈ ਮੰਗ ਕੇ ਲਵੇ ਉਹ ਦਾਜ ਹੈ ਜੋ ਮਾਪੇ ਆਪਣੀ ਸਮਰੱਥਾ ਅਨੁਸਾਰ ਆਪ ਦਿੰਦੇ ਹਨ ਉਹ ਦਾਜ ਨਹੀਂ ਹੈ ਉਹ ਤਾਂ ਲੜਕੀ ਦਾ ਸਨਮਾਨ ਹੈ ਧੰਨਵਾਦ